ਰਾਜ ਦੇ ਆਲੇ ਦੁਆਲੇ ਜਾਣ ਦੇ ਕੁਝ ਤਰੀਕੇ ਹਨ ਜਿਵੇਂ ਸਕੂਟਰ ਬਾਈਕ ਕੈਬ ਕਿਰਾਏ 'ਤੇ ਕਾਰ ਕਿਰਾਏ 'ਤੇ ਪ੍ਰਾਈਵੇਟ ਬੱਸ ਲੋਕਲ ਬੱਸਾਂ ਵਿੱਚ ਵੀ ਰਾਜ ਦੇ ਆਲੇ ਦੁਆਲੇ ਜਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਆਟੋ ਇਲੈਕਟ੍ਰਿਕ ਰਿਕਸ਼ਾ ਸਾਈਕਲ ਮੈਟਰੋ ਵਿੱਚ ਵੀ ਜਾਇਆ ਜਾ ਸਕਦਾ ਹੈ ਯਾਤਰਾ ਲਈ ਆਵਾਜਾਈ ਦਾ ਸਾਧਨ ਸਭ ਤੋਂ ਵਧੀਆ ਹਵਾਈ ਜਹਾਜ ਹੈ ਆਪਣੇ ਘਰ ਦੀ ਕਾਰ ਵੀ ਸਭ ਤੋਂ ਜ਼ਿਆਦਾ ਆਰਾਮਦਾਇਕ ਰਹਿੰਦੀ ਹੈ ਜਿਨ੍ਹਾਂ ਕੋਲ ਕਾਰ ਨਹੀ ਹੈ ਉਹ ਕਿਰਾਏ 'ਤੇ ਕਾਰ ਜਾਂ ਡਰਾਈਵਰ ਲੈ ਸਕਦੇ ਹਨ ਕਿਉਂਕਿ ਯਾਤਰਾ 'ਤੇ ਜਾਣ ਲਈ ਰਾਤ ਵੀ ਰਹਿਣਾ ਪੈਂਦਾ ਹੈ ਦੂਰ ਯਾਤਰਾ ਲਈ ਟ੍ਰੇਨ ਸਭ ਤੋਂ ਵਧੀਆ ਹੈ ਟ੍ਰੇਨ ਵਿੱਚ ਅਸੀਂ ਬਾਥਰੂਮ ਵੀ ਜਾ ਸਕਦੇ ਹਾਂ ਸੋ ਵੀ ਸਕਦੇ ਹਾਂ ਅੱਜ ਕੱਲ੍ਹ ਟ੍ਰੇਨ ਦੇ ਵਿੱਚੋਂ ਟ੍ਰੇਨ ਵੱਲੋਂ ਹੀ ਖਾਣ ਪੀਣ ਦਾ ਸ਼ਾਮ ਦੇ ਨਾਸ਼ਤੇ ਲਈ ਸਵੇਰ ਦੇ ਨਾਸ਼ਤੇ ਲਈ ਰਾਤ ਦੇ ਦੁਪਹਿਰ ਲਈ ਯਾਤਰਾ ਸਾਰਾ ਖਾਣਾ ਗਰਮਾ ਗਰਮ ਮਿਲ ਜਾਂਦਾ ਹੈ ਸਨੈਕ ਵੀ ਹਰ ਕਿਸਮ ਦੇ ਜਿਵੇਂ ਸਮੋਸੇ ਬ੍ਰੈੱਡ ਤਲੀ ਹੋਈ ਟਿੱਕੀ ਕੁਲਚੇ ਚਾਹ ਕਾਫੀ ਸਾਰਾ ਕੁਝ ਗਰਮਾ ਕੁਝ ਚੌਵੀ ਘੰਟੇ ਮਿਲਦਾ ਹੈ ਖਾਣਾ ਵੀ ਰੋਟੀ ਚਾਵਲ ਵੈੱਜ ਨੌਨ ਵੈੱਜ ਸੁੱਕੀ ਸਬਜ਼ੀ ਦਹੀਂ ਦਾਲ ਮਟਰ ਆਲੂ ਪਨੀਰ ਸਬਜ਼ੀ ਨਾਲ ਅਚਾਰ ਵੀ ਮਿਲ ਜਾਂਦਾ ਹੈ ਟ੍ਰੇਨ ਵਿੱਚ ਯਾਤਰਾ ਦੇ ਵਿੱਚ ਕਿਝ ਕਿਧਰੇ ਵੀ ਜਾ ਸਕਦੇ ਹਾਂ ਨੇੜੇ ਤੋਂ ਨੇੜੇ ਦੂਰ ਤੋਂ ਦੂਰ ਪਾਣੀ ਕੋਲਡ ਡਰਿੰਕ ਆਦਿ ਵੀ ਮਿਲ ਜਾਂਦਾ ਹੈ ਬਿਸਕਿਟ ਕੇਕ ਚਿੱਪਸ ਵਗੈਰਾ ਵੀ ਮਿਲ ਜਾਂਦੇ ਹਨ ਘਰ ਵਰਗਾ ਸਾਰੇ ਸੁੱਖ ਹਰ ਵਕਤ ਮਿਲ ਜਾਂਦੇ ਹਨ ਇਸ ਲਈ ਯਾਤਰਾ ਵਾਸਤੇ ਟ੍ਰੇਨ ਬਹੁਤ ਹੀ ਵਧੀਆ ਹੈ ਫਿਰ ਗਰਮੀਆਂ ਵਿੱਚ ਏ ਸੀ ਡੱਬੇ ਵਿੱਚ ਵੀ ਬੈਠ ਕੇ ਅਸੀਂ ਜਾ ਸਕਦੇ ਹਾਂ ਜੇਕਰ ਦੂਰ ਯਾਤਰਾ ਲਈ ਤੁਸੀਂ ਜ਼ਿਆਦਾ ਸਮਾਂ ਟ੍ਰੇਨ ਵਿੱਚ ਨਹੀਂ ਬੈਠਣਾ ਚਾਹੁੰਦੇ ਤਾਂ ਹਵਾਈ ਯਾਤਰਾ ਲਈ ਬਹੁਤ ਹਵਾਈ ਯਾਤਰਾ ਵੀ ਬਹੁਤ ਵਧੀਆ ਹੈ ਇੱਕ ਦਿਨ ਵਿੱਚ ਆਉਣ ਜਾਣ ਕਰ ਸਕਦੇ ਹਾਂ ਸਾਰਾ ਕੁਝ ਖਾਣ ਪੀਣ ਚੋਕਲੇਟ ਹਵਾਈ ਜਹਾਜ ਵਿੱਚ ਮਿਲ ਜਾਂਦਾ ਹੈ ਜੇ ਲੋਕਲ ਯਾਤਰਾ ਕਰਨੀ ਹੋਵੇ ਜਿਵੇਂ ਪੰਜਾਬ ਦੇ ਸਾਰੇ ਗੁਰਦੁਆਰੇ ਉਸ ਲਈ ਦਰਬਾਰ ਸਾਹਿਬ ਵਿੱਚੋਂ ਫਰੀ ਬੱਸ ਸੇਵਾ ਚੱਲਦੀ ਹੈ ਜਿਸ ਦਾ ਕੋਈ ਕਿਰਾਇਆ ਨਹੀਂ ਖਾਣਾ ਪੀਣਾ ਲੰਗਰ ਗੁਰਦੁਆਰਿਆਂ ਚੋਂ ਫਰੀ ਮਿਲ ਜਾਂਦਾ ਹੈ ਰੈਸਟ ਅਰਾਮ ਅਰਾਮ ਕਰਨ ਲਈ ਕਮਰੇ ਫਰੀ ਮਿਲ ਜਾਂਦੇ ਹਨ ਗੁਰਦੁਆਰੇ ਵਿੱਚ ਰਾਤ ਰਹਿਣਾ ਹੋਵੇ ਤਾਂ ਪੂਰਾ ਇੰਤਜ਼ਾਮ ਗੁਰਦੁਆਰਿਆਂ ਵੱਲੋਂ ਕੀਤਾ ਜਾਂਦਾ ਹੈ ਲੋਕਲ ਯਾਤਰਾ ਲਈ ਇਹ ਬੱਸ ਸਭ ਤੋਂ ਵਧੀਆ ਸਾਧਨ ਹੈ ਸੰਗਤਾਂ ਨਾਲ ਯਾਤਰਾ ਵੀ ਹੋ ਜਾਂਦੀ ਹੈ ਅਤੇ ਸੰਗਤਾਂ ਕੀਰਤਨ ਕਰਦੀਆਂ ਜਾਂਦੀਆਂ ਹਨ ਪਾਠ ਕਰਦੀਆਂ ਜਾਂਦੀਆਂ ਹਨ ਸਿਮਰਨ ਕਰਦੀਆਂ ਜਾਂਦੀਆਂ ਹਨ ਸਾਰੇ ਰਸਤੇ ਨਾਮ ਜਪਦੀਆਂ ਜਾਂਦੀਆਂ ਹਨ ਇਸ ਦਾ ਅਲੱਗ ਹੀ ਆਨੰਦ ਹੈ